ਕੁਝ ਸਥਾਨਕ ਕਹਾਣੀਆਂ ਜਾਂ ਕਥਾਵਾਂ ਹਨ ਜੋ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜਾਣੀਆਂ ਜਾਂ ਜਾਣੀਆਂ ਜਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਇੱਕ ਕਹਾਣੀ ਆ ਜਲਿਆਂ ਵਾਲੇ ਬਾਗ ਦੀ ਜੋ ਕਿ ਤੇਰਾਂ ਅਪ੍ਰੈਲ ਉੱਨੀ ਸੌ ਉੱਨੀ ਵਿੱਚ ਹੋਈ ਸੀ ਉਸ ਸਮੇਂ ਉੱਥੇ ਇੱਕ ਵਿਸਾ ਵਿਸਾਖੀ ਦਾ ਬਹੁਤ ਹੀ ਵੱਡਾ ਮੇਲਾ ਲੱਗਾ ਹੋਇਆ ਸੀਗਾ ਜਿਸ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋਏ ਸੀਗੇ ਬਹੁਤ ਜ਼ਿਆਦਾ ਭੀੜ ਸੀ ਉੱਥੇ ਉਸ ਸਮੇਂ ਜਨਰਲ ਡਾਇਰ ਨੇ ਬ੍ਰਿਟਿਸ਼ ਬ੍ਰਿਟਿਸ਼ ਨੂੰ ਹੁਕਮ ਦਿੱਤਾ ਸੀਗਾ ਕਿ ਉਹ ਉਹਨਾਂ ਲੋਕਾਂ ਉੱਤੇ ਗੋਲੀਆਂ ਚਲਾਈਆਂ ਜਾਣ ਅਤੇ ਉਹਨਾਂ ਸਾਰੇ ਲੋਕਾਂ ਨੂੰ ਮਾਰ ਦਿੱਤਾ ਜਾਵੇ ਜਲਿਆਂ ਉੱਥੋਂ ਜਲਿਆਂ ਵਾਲੇ ਬਾਗ ਦੀ ਜੋ ਜੋ ਐਂਟਰਿੰਗ ਸੀ ਉਹ ਬਹੁਤ ਹੀ ਜ਼ਿਆਦਾ ਪਤਲੀ ਸੀਗੀ ਇਸ ਕਰਕੇ ਉਹ ਉਸ ਉਸ ਪਤ ਐਂਟਰਸ ਨੂੰ ਬ੍ਰਿਟਿਸ਼ ਦੁਆਰਾ ਕਵਰ ਕੀਤਾ ਗਿਆ ਸੀਗਾ ਤਾਂ ਕਿ ਲੋਕ ਉਸ ਥਾਈਂ ਬਾਹਰ ਨਾ ਜਾ ਸਕਣ ਅਤੇ ਲੋਕਾਂ ਉੱਤੇ ਗੋਲੀ ਬਾਰਿਸ਼ਾਂ ਕੀਤੀਆਂ ਗਈਆਂ ਸੀ ਜਿੱਥੇ ਕਿ ਬਹੁਤ ਸਾਰੇ ਔਰਤਾਂ ਬੱਚੇ ਜਾਂ ਬਜ਼ੁਰਗ ਵੀ ਸੀਗੇ ਜਿਨ੍ਹਾਂ ਸਾਰਿਆਂ ਨੂੰ ਉਹਨਾਂ ਨੇੇ ਮਾਰ ਦਿੱਤਾ ਗਿਆ ਸੀਗਾ ਜੋ ਵੀ ਲੋ ਜਿਨ੍ਹਾਂ ਵੀ ਲੋਕਾਂ ਨੇ ਇਹ ਕਹਾਣੀ ਆਪਣੇ ਅੱਖੀ ਦੇਖੀ ਹੋਈ ਆ ਉਹ ਅੱਜ ਵੀ ਅਗਰ ਉਸ ਕਹਾਣੀ ਨੂੰ ਯਾਦ ਕਰਦੇ ਹਨ ਤਾਂ ਰੋ ਪੈਂਦੇ ਹਨ ਸ਼ਹੀਦ ਊਧਮ ਸਿੰਘ ਸ਼ ਸ਼ਹੀਦ ਊਧਮ ਸਿੰਘ ਜੀ 'ਤੇ ਇਸ ਗੱਲ ਦਾ ਬਹੁਤ ਹੀ ਡੂੰਘਾ ਅਸਰ ਹੋਇਆ ਸੀ ਜ ਜਦੋਂ ਇਹ ਕਹਾਣੀ ਉਹਨਾਂ ਨੇ ਸੁਣੀ ਸੀਗੀ ਜਿੱਦਾਂ ਹੁਣ ਉਸ ਤੋਂ ਬਾਅਦ ਸ਼ਹੀਦ ਊਧਮ ਸਿੰਘ ਜੀ ਨੇ ਅਸੈਂਬਲੀ ਵਿੱਚ ਜਾ ਕੇ ਜਨਰਲ ਡਾਇਰ ਨੂੰ ਗੋਲੀ ਮਾਰ ਦਿੱਤੀ ਗਈ ਸੀ ਅੱਜ ਵੀ ਉੱਥੇ ਅਗਰ ਆਪਾਂ ਜਾ ਕੇ ਦੇਖੀਏ ਤਾਂ ਉੱਥੇ ਗੋਲੀਆਂ ਦੇ ਨਿਸ਼ਾਨ ਮੌਜੂਦ ਹਨ ਜੋ ਕਿ ਸਾਰੇ ਦੇਖ ਸਕਦੇ ਹਨ ਉਸ ਟਾਈਮ ਸਾਰੇ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਕ ਕੋਈ ਕੰਧਾਂ ਟੱਪ ਰਿਹਾ ਸੀ ਅਤੇ ਕੋਈ ਖੂਹ ਦੇ ਵਿੱਚ ਛਾਲ ਮਾਰ ਰਿਹਾ ਸੀਗਾ ਉਹ ਖੂਹ ਅੱਜ ਵੀ ਉਸ ਸਮੇਂ ਮੌਜੂਦ ਹੈ ਅਤੇ ਆਪਾਂ ਅਗਰ ਉੱਥੇ ਜਾ ਕੇ ਦੇਖਦੇ ਹਾਂ ਤਾਂ ਉੱਥੇ ਸਾਰੀ ਐਲ ਈ ਡੀ ਉੱਤੇ ਸਾਰਾ ਇਤਿਹਾਸ ਸ਼ੋਅ ਕੀਤਾ ਜ਼ਾਂਦਾ ਹੈ ਬਾਹਰੋਂ ਬਹੁਤ ਦੂਰ ਦੂਰ ਦੇ ਲੋਕ ਉਸ ਜਲਿਆਂ ਵਾਲੇ ਬਾਗ ਨੂੰ ਦੇਖਣ ਲਈ ਆਉਂਦੇ ਹਨ ਥੈਂਕ ਯੂ